ਹਾਂਜੀ ਮੈਨੂੰ ਟਰੈਵਲਿੰਗ ਬਹੁਤ ਪਸੰਦ ਹੈ ਅਤੇ ਮੈਂ ਹਮੇਸ਼ਾ ਛੁੱਟੀਆਂ ਵਿੱਚ ਕਿਤੇ ਪਲੈਨ ਕਰਦਾ ਹਾਂ ਅਤੇ ਮੈਨੂੰ ਯਾਦ ਹੈ ਵੀ ਲਾਸਟ ਮਹੀਨੇ ਅਸੀਂ ਅੰਮ੍ਰਿਤਸਰ ਗਏ ਸੀ ਮੱਥਾ ਟੇਕਣ ਅਤੇ ਮੈਂ ਆਪਣੀ ਫੈਮਿਲੀ ਦੇ ਨਾਲ ਪਲਾਨ ਕੀਤਾ ਸੀ ਅਤੇ ਅਸੀਂ ਵੋਲਵੋ ਬੱਸ ਬੁੱਕ ਕਰਵਾ ਲਈ ਰੋਪੜ ਤੋਂ ਅੰਮ੍ਰਿਤਸਰ ਸੋ ਏ ਸੀ ਏ ਫੁਲੀ ਏਅਰ ਕੰਡੀਸ਼ਨਡ ਸੀ ਅਤੇ ਅਸੀਂ ਬੜਾ ਇੰਜੋਏ ਕੀਤਾ ਜਰਨੀ ਦੇ ਦੁਆਰਾ ਕੰਮਫਰਟ ਸੀ ਸੀਟਾਂ ਬੜੀਆਂ ਕੰਮਫਰਟ ਸੀ ਮੂਬੈਵਲ ਸੀ ਅਤੇ ਏ ਸੀ ਵਰਕ ਕਰ ਰਿਹਾ ਸੀ ਪਰੋਪਰ ਕੰਮ ਕਰ ਰਿਹਾ ਸੀ ਅਤੇ ਐਲ ਈ ਡੀ ਲੱਗੀ ਸੀਗੀ ਅਤੇ ਅਸੀਂ ਫਿਲਮ ਵੀ ਧਾਰਮਿਕ ਫਿਲਮ ਲੱਗੀ ਹੋਈ ਸੀ ਕਿਉਂ ਕਿਉਂਕਿ ਅਸੀਂ ਅੰਮ੍ਰਿਤਸਰ ਜਾ ਰਹੇ ਸੀ ਅਤੇ ਅਸੀਂ ਇੰਜੋਏ ਕਰ ਰਹੇ ਸੀ ਨਾਲ ਨਾਲ ਧਾਰਮਿਕ ਫਿਲਮ ਬੜਾ ਅੱਛਾ ਲੱਗਿਆ ਸਾਨੂੰ ਫੈਮਿਲੀ ਨੂੰ ਵੀ ਕਾਫੀ ਅੱਛਾ ਲੱਗਿਆ ਅਤੇ ਡਰਾਈਵਰ ਵੀ ਬੱਸ ਬਿਲਕੁਲ ਆਈ ਮੀਨ ਸਹੀ ਤਰੀਕੇ ਨਾਲ ਚਲਾ ਰਿਹਾ ਸੀ ਅਤੇ ਉਸ ਤੋਂ ਬਾਅਦ ਅਵਾਜ਼ ਵਾਈਸ ਇੰਜਨ ਦੀ ਵੀ ਜ਼ਿਆਦਾ ਵਾਈਸ ਨਹੀਂ ਸੀ ਬਿਲਕੁਲ ਨੋਰਮਲ ਸੀ ਸੀ ਸਾਰਾ ਅਤੇ ਅਸੀਂ ਬੜੇ ਖੁਸ਼ ਹੋਏ ਕਿਉਂਕਿ ਅਸੀਂ ਟਾਈਮ ਸਿਰ ਪਹੁੰਚ ਗਏ ਉੱਥੇ ਅਤੇ ਅਸੀਂ ਉੱਥੇ ਮੱਥਾ ਟੇਕਿਆ ਅਤੇ ਆਪਣਾ ਮੈਡੀਟੇਸ਼ਨ ਪੇਅ ਕੀਤੀ ਅਤੇ ਅਸੀਂ ਲੰਗਰ ਖਾਧਾ ਬਾਅਦ ਵਿੱਚ ਗੁਰਦੁਆਰਾ ਸਾਹਿਬ ਤੋਂ ਬਹੁਤ ਅੱਛਾ ਲੱਗਿਆ ਔਵਰਆਲ ਕਾਫੀ ਅੱਛਾ ਸਾਨੂੰ ਮਹਿਸੂਸ ਹੋਇਆ